ਲੁਧਿਆਣੇ ਜ਼ਿਲ੍ਹੇ ਵਿੱਚ ਬਹੁਤ ਸਾਰੇ ਰਿਹਾਇਸ਼ੀ ਵਿਕਲਪ ਹਨ ਜੋ ਕਿ ਜੋ ਕਿ ਘਰਾਂ ਵਿੱਚ ਹੀ ਕਿਰਾਏ ਕਿਰਾਏ ਲਈ ਹੁੰਦੇ ਹਨ ਮਾਰਕੀਟ ਵਿੱਚ ਛੋਟੀ ਛੋਟੀ ਦੀਕ ਦੁਕਾਨਾਂ ਵਿਕਾਊ ਹੁੰਦੀਆਂ ਹਨ ਤੇ ਉਨ ਉਹਨਾਂ ਦਾ ਬਹੁਤ ਹੀ ਮੁਨਾਫਾ ਉਹਨਾਂ ਨੂੰ ਮਿਲਦਾ ਹੈ ਕਿਰਾਏ ਦੇ ਰੂਪ ਵਿੱਚ ਤੇ ਛੋਟੇ ਘਰਾਂ ਦਾ ਕਿਰਾਇਆ ਆ ਲਗਭਗ ਪੰਜ ਹਜਾਰ ਤੋਂ ਛੇ ਹਜਾਰ ਤੱਕ ਦਾ ਹੁੰਦਾ ਹੈ ਬਾਹਰੋਂ ਆਉਣ ਵਾਲੇ ਲੋਕ ਜੋ ਵੀ ਲੁਧਿਆਣੇ ਵਿੱਚ ਰਹਿੰਦੇ ਹਨ ਉਹ ਆਪਣੇ ਕਿਰਾ ਕਿਰਾਏ ਤੇ ਕਮਰੇ ਲੈ ਕੇ ਹੀ ਆਪਣਾ ਗੁਜਾਰਾ ਕਰਦੇ ਹਨ ਤੇ ਉਹਨਾਂ ਨੂੰ ਬਹੁਤ ਹੀ ਇਸ ਚੀਜ਼ ਦੀਆਂ ਸਹੂਲਤਾਂ ਮਿਲਦੀਆਂ ਹਨ ਇਸ ਚੀਜ਼ ਦਾ ਹਰੇਕ ਵਿਅਕਤੀ ਨੂੰ ਫਾਇਦਾ ਹੁੰਦਾ ਹੈ ਕਿਰਾਏ ਦੇਣ ਵਾਲੇ ਦਾ ਕਿਰਾਏ ਤੇ ਕਮਰਾ ਦੇਣ ਵਾਲੇ ਦਾ ਵੀ ਤੇ ਕਿਰਾਇਆ ਭਰਨ ਵਾਲੇ ਦਾ ਵੀ